ਹੈਲੋ ਕੀ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਜੀ ਮੈਂ ਅਭਿਸ਼ੇਕ ਪਠਾਨਕੋਟ ਤੋਂ ਬੋਲ ਰਿਹਾ ਹਾਂ ਮੈਂ ਬਰਦਰਸ ਬੇਕਰੀ ਤੋਂ ਆਪਣੇ ਛੋਟੇ ਭਰਾ ਦੇ ਜਨਮ ਦਿਨ ਲਈ ਕੁਝ ਔਡਰ ਕੀਤਾ ਸੀ ਜਿਸ ਵਿੱਚ ਇੱਕ ਪਾਈਨਐਪਲ ਕੇਕ ਤੀਹ ਸਮੋਸੇ ਤੀਹ ਸਪਰਿੰਗ ਰੋਲ ਦੇ ਪੀਸ ਅਤੇ ਕੁਝ ਪਨੀਰ ਪਕੌੜੇ ਵੀ ਸਨ ਅਤੇ ਡਿਨਰ ਵਿੱਚ ਮੈਂ ਦਾਲ ਮੱਖਣੀ ਨਾਨ ਮਿਕਸ ਸਬਜ਼ੀ ਅਤੇ ਪੁਲਾਓ ਵੀ ਔਡਰ ਕੀਤਾ ਸੀ ਜੀ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡਾ ਔਡਰ ਕਿੰਨੇ ਵਜੇ ਤੱਕ ਆਏਗਾ ਕਿਉਂਕਿ ਪਹਿਲੇ ਤੁਹਾਡੀ ਟਾਈਮਿੰਗ ਪੰਜ ਵਜੇ ਦੀ ਸੀ ਪਰ ਹਜੇ ਤੱਕ ਤੁਹਾਡਾ ਔਡਰ ਨਹੀਂ ਆਇਆ ਛੇ ਵੱਜ ਚੁੱਕੇ ਹਨ ਅਤੇ ਸਾਰੇ ਪਰਾਹੁਣੇ ਵੀ ਆ ਚੁੱਕੇ ਹਨ ਸਾਰੇ ਪਰਾਹੁਣੇ ਕੇਕ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਉਹ ਬੇਸਬਰੇ ਹਨ ਇਸ ਕਰਕੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡਾ ਔਡਰ ਕਿੰਨੇ ਵਜੇ ਤੱਕ ਆਏਗਾ ਜੇ ਅਗਰ ਤੁਹਾਡਾ ਔਡਰ ਨਹੀਂ ਆ ਸਕਦਾ ਤਾਂ ਕਿਰਪਾ ਕਰਕੇ ਤੁਸੀਂ ਮੇਰੇ ਪੈਸੇ ਰਿਫੰਡ ਕਰ ਸਕਦੇ ਹੋ ਤਾਂ ਜੋ ਮੈਂ ਕਿਤੇ ਹੋਰ ਔਡਰ ਕਰ ਕੇ ਆਪਣੇ ਛੋਟੇ ਭਰਾ ਦੇ ਜਨਮਦਿਨ ਨੂੰ ਖੁਸ਼ੀ ਨਾਲ ਮਨਾ ਸਕਾਂ ਧੰਨਵਾਦ